ਹਾਂਜੀ ਸਰ ਸਰ ਅਨੇਜਾ ਸਵੀਟਸ ਤੋਂ ਬੋਲ ਰਹੇ ਹੋ ਸਰ ਮੈਂ ਤੁਹਾਨੂੰ ਇੱਕ ਸ਼ਿਕਾਇਤ ਕਰਨੀ ਸੀ ਸਰ ਮੈਂ ਤੁਹਾਡੇ ਉਹਦੇ 'ਤੇ ਇੱਕ ਪੀਜ਼ਾ ਔਡਰ ਕੀਤਾ ਸੀਗਾ ਰੈਸਟੋਰੈਂਟ ਤੋਂ ਜਿਹੜਾ ਪੀਜ਼ਾ ਹੈ ਸਰ ਅਜੇ ਤੱਕ ਮੇਰੇ ਕੋਲ ਜਿਹੜਾ ਪਹੁੰਚਿਆ ਨਹੀਂ ਹੈਗਾ ਸਰ ਮੈਂ ਜਿਹੜਾ ਤੁਹਾਡਾ ਡਿਲੀਵਰੀ ਏਜੰਟ ਹੈ ਉਹਦੀ ਲੋਕੇਸ਼ਨ ਚੈੱਕ ਕੀਤੀ ਸੀ ਕੁਝ ਟਾਈਮ ਪਹਿਲਾਂ ਉਹ ਪੰਜ ਮਿੰਟ ਦਾ ਡਿਸਟੈਂਸ ਹੈ ਜਿਹੜਾ ਉਹ ਸ਼ੋਅ ਕਰ ਰਿਹਾ ਸੀ ਪਰ ਸਰ ਹੁਣ ਮੈਂ ਜਦੋਂ ਦੁਬਾਰਾ ਚੈੱਕ ਕੀਤੀ ਹੈ ਤਾਂ ਉਹਨਾਂ ਦੀ ਜਿਹੜੀ ਕੋਈ ਲੋਕੇਸ਼ਨ ਨਹੀਂ ਆ ਰਹੀ ਸਰ ਤੁਸੀਂ ਮੈਨੂੰ ਇਹ ਜਿਹੜੀ ਮੈਂ ਤੁਹਾਨੂੰ ਸ਼ਿਕਾਇਤ ਕੀਤੀ ਆ ਪਲੀਜ਼ ਮੈਨੂੰ ਤੁਸੀਂ ਦੱਸੋਗੇ ਵੀ ਮੇਰੇ ਤੱਕ ਜਿਹੜਾ ਇਹ ਪੀਜ਼ਾ ਪਹੁੰਚੇਗਾ ਕਿ ਨਹੀਂ ਪਹੁੰਚੇਗਾ ਅਤੇ ਕਦੋਂ ਤੱਕ ਪਹੁੰਚੇਗਾ ਜੇ ਪਹੁੰਚੇਗਾ ਵੀ ਤਾਂ ਉਹ ਬਹੁਤ ਠੰਡਾ ਹੋਇਆ ਹੋਵੇਗਾ ਸਰ ਸਰ ਇਸ ਚੀਜ਼ ਨੂੰ ਲੈ ਕੇ ਤੁਸੀਂ ਮੇਰੀ ਜਿਹੜੀ ਮਤਲਬ ਕਿ ਇਹ ਪ੍ਰੋਬਲਮ ਨੂੰ ਸੋਲਵ ਕਰਿਓ ਅਤੇ ਮੇਰੇ ਤੱਕ ਮੇਰੀ ਪੇਮੈਂਟ ਜਿਹੜੀ ਸਰ ਉਹ ਵਾਪਸ ਆਏਗੀ ਜਾਂ ਮੈਨੂੰ ਪੀਜ਼ਾ ਮਿਲੇਗਾ ਜਾਂ ਦੁਬਾਰਾ ਤੋਂ ਕੁਛ ਇਹਦਾ ਸਲਿਊਸ਼ਨ ਹੋਏਗਾ ਜੋ ਵੀ ਹੋਏਗਾ ਸਰ ਪਲੀਜ਼ ਤੁਸੀਂ ਮੇਰੀ ਹੈਲਪ ਕਰਨਾ ਜ਼ਰੂਰ